ਹੈਲੋ ਹੰਗਰੀ ਪੁਆਇੰਟ ਮੈਂ ਕੁਝ ਓਡਰ ਕਰਨੇ ਆ ਮੈਨੂੰ ਪੰਜ ਪੀਜ਼ਾ ਅਤੇ ਦਸ ਬਰਗਰ ਚਾਹੀਦੇ ਨੇ ਅਤੇ ਮੈਨੂੰ ਉਨ੍ਹਾਂ ਪੀਜ਼ਿਆਂ ਦੇ ਨਾਲ ਪੀਜ਼ਿਆਂ ਦੇ ਵਿੱਚ ਸ ਐਕਸਟਰਾ ਸਬਜ਼ੀਆਂ ਚਾਹੀਦੀਆਂ ਨੇ ਅਤੇ ਉਨ੍ਹਾਂ ਦੇ ਨਾਲ ਮੈਨੂੰ ਟਮੈਟੋ ਚਟਨੀ ਅਤੇ ਭੇਜ ਦਿਓ ਅਤੇ ਨਾਲ ਜਿਹੜੇ ਚਿੱਲੀ ਫਲੇਕਸ ਓਰਗੈਨੋ ਵਗੈਰਾ ਵੀ ਭੇਜ ਦਿਓ ਅਤੇ ਜਿਹੜੇ ਤੁਸੀਂ ਬਰਗਰ ਭੇਜੋਂਗੇ ਉਨ੍ਹਾਂ ਵਿੱਚ ਵੀ ਮੈਨੂੰ ਐਕਸਟਰਾ ਸੋਸ ਚਾਹੀਦੀ ਆ ਅਤੇ ਉਹ ਤੁਸੀਂ ਜ਼ਰੂਰ ਭੇਜ ਦਿਓ